ਮਾਨਸਾ ਜ਼ਿਲ੍ਹਾ ਦੇ ਵਿੱਚ ਮੁੱਖ ਮਨੋਰੰਜਨ ਗਤੀਵਿਧੀਆਂ ਅਤੇ ਮਨੋਰੰਜਨ ਦੇ ਵਿਕਲਪ ਕਾਫੀ ਹਨ ਜਿਵੇਂ ਕਿ ਮਾਨਸਾ ਦੇ ਵਿੱਚ ਇੱਕ ਸੈਂਟਰ ਪਾਰਕ ਦੇ ਨਾਮ ਤੋਂ ਪਾਰਕ ਕਾਫੀ ਜ਼ਿਆਦਾ ਪ੍ਰਚਲਿਤ ਹੈ ਉਸ ਦੇ ਵਿੱਚ ਖੇਡਾਂ ਖੇਡਣ ਦੇ ਲਈ ਬਾਸਕਿਟਵੋਲ ਵਾਲੀਬੋਲ ਅਤੇ ਬੈਡਮਿੰਟਨ ਜਿਹੇ ਗਰਾਊਂਡ ਉਪਲਬਧ ਹਨ ਉਸਦੇ ਵਿੱਚ ਕਾਫੀ ਜ਼ਿਆਦਾ ਹਰਿਆਲੀ ਹੋਣ ਦੇ ਕਾਰਨ ਜੰਗਲ ਵਗੈਰਾ ਹੋਣ ਦੇ ਕਾਰਨ ਉੱਥੇ ਪੰਛੀਆਂ ਦੀ ਚਹਿਚਾਹਟ ਇੱਕ ਅਲੱਗ ਹੀ ਸਕੂਨ ਭਰਿਆ ਮਨੋਰੰਜਨ ਦਿੰਦੀ ਹੈ ਸੈਂਟਰ ਪਾਰਕ ਦੇ ਵਿੱਚ ਹਰ ਵਰਗ ਦਾ ਵਿਅਕਤੀ ਜਿਵੇਂ ਕਿ ਛੋਟੇ ਬੱਚੇ ਵੱਡੇ ਬਜ਼ੁਰਗ ਅਤੇ ਜਵਾਨ ਉੱਥੇ ਯੋਗਾ ਕਰਨ ਖੇਲਣ ਸੈਰ ਕਰਨ ਦੇ ਲਈ ਰੂਟੀਨ ਹੀ ਆਉਂਦੇ ਹਨ ਇਸ ਤੋਂ ਇਲਾਵਾ ਮਾਨਸਾ ਦੇ ਵਿੱਚ ਸਿਨੇਮਾ ਹੈ ਜਿਸ ਨੂੰ ਮਨੋਰੰਜਨ ਦੇ ਲਈ ਇੱਕ ਵਧੀਆ ਸਹੂਲਤ ਦਿੱਤੀ ਗਈ ਹੈ ਮਾਨਸਾ ਨੂੰ ਉਸ ਦੇ ਵਿੱਚ ਕਾਫੀ ਜ਼ਿਆਦਾ ਫੈਸਲਿਟੀ ਜਿਵੇਂ ਕਿ ਖਾਣਾ ਖਾਣ ਦੇ ਲਈ ਚੰਗੇ ਬਾਥਰੂਮ ਵਗੈਰਾ ਕੋਈ ਬੀਅਰ ਵਗੈਰਾ ਕਲੱਬ ਸਭ ਕੁਝ ਉੱਥੇ ਫਸੀਲਟੀ ਹੈ ਇਸ ਤੋਂ ਇਲਾਵਾ ਮਾਨਸਾ ਦੇ ਵਿੱਚ ਸਮਰਾਟ ਸਿਨਮਾ ਵੀ ਹੈ ਜੋ ਕਿ ਬਹੁਤ ਹੀ ਪੁਰਾਣਾ ਹੋ ਚੁੱਕਿਆ ਹੈ ਪਰ ਫਿਰ ਵੀ ਉਹ ਲੋਕਾਂ ਦੇ ਮਨੋਰੰਜਨ ਦਾ ਇੱਕ ਵਧੀਆ ਸਾਧਨ ਹੈ ਫਿਰ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਕੋਠੀ ਹਵੇਲੀ ਮੂਸਾ ਪਿੰਡ ਦੇ ਵਿੱਚ ਬਿਰਾਜਮਾਨ ਹੈ ਜਿੱਥੇ ਕਿ ਵੱਖ ਵੱਖ ਦੇਸ਼ਾਂ ਤੋਂ ਲੋਕ ਘੁੰਮਣ ਦੇ ਲਈ ਦੇਖਣ ਦੇ ਲਈ ਆਉਂਦੇ ਹਨ ਧੰਨਵਾਦ